ਨਹੀਂ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਸਾਡਾ ਮੀਡੀਆ ਹੈਗਾ ਉਹ ਸਾਡੇ ਪੇਂਡੂ ਖੇਤਰਾਂ ਦੀਆਂ ਕੋਈ ਵੀ ਮੁੱਦੇ 'ਤੇ ਕੋਈ ਦਿਖਾ ਗੱਲ ਕਰਦਾ ਹੈ ਜਾਂ ਕੋਈ ਦਿਖਾਉਂਦਾ ਹੈ ਅਤੇ ਪੰਜਾਬ ਦੇ ਕਈ ਮੁੱਦੇ ਹਨ ਪੰਜਾਬ ਦੇ ਪਿੰਡਾਂ ਦੇ ਕਈ ਮੁੱਦੇ ਹਨ ਅਤੇ ਜਿੱਥੇ ਮੀਡੀਆ ਵਿੱਚ ਗੱਲ ਨਹੀਂ ਕੀਤੀ ਜਾਂਦੀ ਜਿੱਦਾਂ ਕਿ ਸਾਡੇ ਕੁਛ ਪੰਜਾਬ ਇੱਕ ਖੇਤੀ ਰਾਜ ਹੈਗਾ ਅਤੇ ਪੰਜਾਬ ਨੂੰ ਉਹਦੇ ਜਿੱਦਾਂ ਕਿ ਖੇਤੀ ਰਾਜ ਦੇ ਅਕੋਰਡਿੰਗ ਉਹਨਾਂ ਨੂੰ ਪ੍ਰੋਪਰ ਫਸਿਲਟੀਆਂ ਮਿਲਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਕਿਸਾਨ ਅੱਗੇ ਵਧੇ ਅਤੇ ਹੋਰ ਖੇਤੀ ਵਧੇ ਕਿਉਂਕਿ ਸਾਡਾ ਵਪਾਰ ਵੀ ਇਸੇ ਸਿਰ 'ਤੇ ਚੱਲਦਾ ਹੈ ਦੂਜੀ ਗੱਲ ਪੰਜਾਬ ਦੀ ਮਿੱਟੀ ਹੁਣ ਖ਼ਤਮ ਹੋ ਰਹੀ ਹੈ ਹੌਲੀ ਹੌਲੀ ਅਤੇ ਮੀਡੀਆ ਨੂੰ ਚਾਹੀਦਾ ਕਿ ਇਸ ਮੁੱਦੇ ਨੂੰ ਚੱਕੇ ਸਰਕਾਰ ਅੱਗੇ ਲੈ ਕੇ ਜਾਵੇ ਅਤੇ ਸਰਕਾਰ ਕੁਛ ਇੱਦਾਂ ਦੇ ਕੁਛ ਨਵਾਂ ਕੁਛ ਲੈ ਕੇ ਆਵੇ ਜਿਹਦੇ ਨਾਲ ਅਸੀਂ ਘੱਟ ਤੋਂ ਘੱਟ ਦਵਾਈਆਂ ਯੂਜ਼ ਕਰੀਏ ਅਤੇ ਨੈਚੁਰਲ ਖੇਤੀ ਵੱਲ ਜ਼ਿਆਦਾ ਵਧੀਏ